ਤਕਨੋਲਜੀ ਨੇ ਵੱਖ ਵੱਖ ਖੇਤਰਾਂ ਦੇ ਵਿੱਚ ਬਹੁਤ ਸਾਰੀਆਂ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਹਨ ਅਤੇ ਇਸ ਸੰਬੰਧ ਵਿੱਚ ਜੇਕਰ ਅਸੀਂ ਕਲਾ ਉਦਯੋਗ ਅਤੇ ਕਲਾਕਾਰ ਭਾਈਚਾਰੇ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਤਕਨੋਲਜੀ ਨੇ ਬਹੁਤ ਮਦਦ ਕੀਤੀ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਪਲੇਟਫੋਰਮ ਦੇ ਉੱਪਰ ਤੁਸੀਂ ਦੇਖਦੇ ਹੋ ਕਿ ਹਰੇਕ ਹੀ ਬੰਦਾ ਆਪਣੀ ਇੱਕ ਸ਼ੋਰਟ ਵੀਡੀਓ ਬਣਾ ਕੇ ਪੋਸਟ ਕਰ ਦਿੰਦਾ ਹੈ ਅਤੇ ਇਹ ਵੀ ਇੱਕ ਤਕਨੋਲਜੀ ਦਾ ਕ੍ਰਾਂਤੀਕਾਰੀ ਕਦਮ ਹੈ ਅਤੇ ਬਹੁਤ ਸਾਰੇ ਇਸ ਸੰਬੰਧ ਵਿੱਚ ਬਹੁਤ ਸਾਰੇ ਆਪੋ ਆਪਣੇ ਨਿਊਜ ਚੈਨਲ ਵੀ ਅੱਜ ਕੱਲ੍ਹ ਬਹੁਤ ਉੱਭਰ ਰਹੇ ਹਨ ਅਤੇ ਔਨ ਲਰਨਿੰਗ ਔਨਲਾਈਨ ਲਰਨਿੰਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਔਨਲਾਈਨ ਲਰਨਿੰਗ ਦੇ ਵੀ ਬਹੁਤ ਸਾਰੇ ਜੋ ਸੋਰਸ ਹਨ ਉਹ ਬਹੁਤ ਉਪਲਬਧ ਹਨ ਅਤੇ ਇਹ ਨਾ ਇਹ ਲਰਨਿੰਗ ਦੇ ਵਿੱਚ ਕਲਾਕਾਰ ਵੀ ਆਪਣੀ ਕਲਾ ਨੂੰ ਹੋਰ ਕਿੱਦਾਂ ਵਧੇਰੇ ਨਿਖਾਰਨਾ ਹੈ ਉਹ ਉਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਕਲਾ ਉਦਯੋਗ ਨਾਲ ਸੰਬੰਧਿਤ ਵੀ ਬਹੁਤ ਸਾਰੀ ਤਕਨੀਕੀ ਜਾਣਕਾਰੀ ਔਨਲਾਈਨ ਯੂਟਿਊਬ ਵਗੈਰਾ ਦੇ ਉੱਪਰ ਬਹੁਤ ਸਾਰੀ ਉਪਲੱਬਧ ਹੈ ਅਤੇ ਇਸ ਤਰ੍ਹਾਂ ਵਿਦਿਆਰਥੀਆਂ ਨੂੰ ਕਲਾਕਾਰਾਂ ਨੂੰ ਅਤੇ ਕਲਾ ਉਦਯੋਗ ਨਾਲ ਸੰਬੰਧਿਤ ਵਿਅਕਤੀਆਂ ਨੂੰ ਬਹੁਤ ਜ਼ਿਆਦਾ ਅਕਸਪੋਜ਼ਰ ਮਿਲਦਾ ਹੈ ਜੀ